ਸਤਿ ਸ਼੍ਰੀ ਅਕਾਲ ਸਾਰਿਆਂ ਜਣਿਆਂ ਨੂੰ ਮੈਂ ਰਮਨਦੀਪ ਤੁਹਾਡੇ ਸਾਰੇ ਜਣਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਖੇਡਾਂ ਅਤੇ ਪਾਠਕਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਕਿਹੜੀਆਂ ਹੋ ਸਕਦੀਆਂ ਜਿਹਦੇ ਵਿੱਚ ਆਪਾਂ ਬੱਚੇ ਦੀ ਨੌਲੇਜ ਦੇ ਵਿੱਚ ਵਾਧਾ ਕਰ ਸਕਦੇ ਹਾਂ ਉਹਨਾਂ ਦੇ ਨਾਲ ਓਵਰਆਲ ਉਹਨਾਂ ਦਾ ਸਰਵ ਪੱਖੀ ਵਿਕਾਸ ਕਰ ਸਕਦੇ ਹਾਂ ਜਿਹਨੂੰ ਕਹਿੰਦੇ ਓਵਰਆਲ ਡਿਵੈਲਪਮੈਂਟ ਜਿੱਦਾਂ ਕਹਿ ਸਕਦੇ ਹਾਂ ਵੀ ਅਸੀਂ ਉਹ ਕਿਹੜੀਆਂ ਚੀਜ਼ਾਂ

ਇਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਬੱਚੇ ਨੂੰ ਸਾਨੂੰ ਜਿਹੜੇ ਸਾਡੇ ਛੋਟੇ ਬੱਚਿਆਂ ਹੁੰਦੇ ਆ ਜਦੋਂ ਆਪਾਂ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਬੈਠਦੇ ਹਾਂ ਪਹਿਲੇ ਨੰਬਰ 'ਤੇ ਸਾਨੂੰ ਉਹਨਾਂ ਨੂੰ ਸੱਚ ਬੋਲਣਾ ਸਿਖਾਉਣਾ ਚਾਹੀਦਾ ਵਾ ਵੀ ਜ਼ਿਦਗੀ ਦੇ ਵਿੱਚ ਹਮੇਸ਼ਾ ਹੀ ਸੱਚ ਬੋਲਣਾ ਵਾ ਭਾਵੇਂ ਸੱਚ ਬੋਲਣਾ ਥੋੜ੍ਹਾ ਜਿਹਾ ਔਖਾ ਲੱਗਦਾ ਵਾ ਪਰ ਹਮੇਸ਼ਾ ਸੱਚ ਹੀ ਬੋਲੋ ਇਹ ਇਹੋ ਜਿਹੀਆਂ ਹੋਰ ਵੀ ਕਈ ਚੀਜ਼ਾਂ ਦਾ ਬੱਚਿਆ ਨੂੰ ਸਾਨੂੰ ਧਿਆਨ ਦੇਣਾ ਚਾਹੀਦਾ ਵਾ ਜਿਹਦੇ ਵਿੱਚ ਮੋਰਲ ਵੈਲਿਉਸ ਵਗ਼ੈਰਾ ਆ ਜਾਂਦੀਆ ਵਾ ਐਥਿਕਸ ਆ ਜਾਂਦੇ ਆ ਸਾਡੇ ਬੱਚਿਆਂ ਦੇ ਵਿੱਚ ਜਦੋਂ ਰਹਿੰਦੇ ਆ ਬੱਚੇ ਬੱਚੇ ਬੱਚਿਆਂ ਦੇ ਵਿੱਚ ਰਹਿੰਦੇ ਆ ਸਾਨੂੰ ਉਹ ਸਾਡੇ ਵੱਲ ਵੇਖ ਕੇ ਸਿੱਖਦੇ ਆ ਸਾਨੂੰ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਵੱਲ ਤੋਂ ਪ੍ਰਭਾਵਿਤ ਸਾਡੇ ਵੱਲ ਵੇਖ ਕੇ ਓਹੀ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਆ ਜਿੱਦਾਂ ਅਸੀਂ ਕਰਦੇ ਹਾਂ ਜਿੱਦਾਂ ਅਸੀਂ ਕਰਦੇ ਹਾਂ ਬੱਚੇ ਸੇਮ ਟੂ ਸੇਮ ਸਾਡੇ ਵੱਲ ਵੇਖ ਕੇ ਜਿਹੜਾ ਬਹੁਤ ਪ੍ਰਭਾਵਿਤ ਹੁੰਦੇ ਆ ਸਾਨੂੰ ਬੱਚਿਆਂ ਦੇ ਲਾਗੇ ਇੱਕ ਵਧੀਆ ਮੋਰਲ ਵਧੀਆ ਐਥਿਕਸ ਵਧੀਆ ਪਹਿਰਾਵਾ ਅਤੇ ਸਾਰਾ ਕੁਛ ਮਤਲਬ ਕਿ ਇੱਕ ਇਕਦਮ ਸਿੰਪਲ ਸੁੱਚਾ ਸਾਚਾ ਜੀਵਨ ਜਿਹੜਾ ਵਾ ਜਿਊਣਾ ਚਾਹੀਦਾ ਵਾ ਤਾਂ ਕਿ ਉਹ ਵੇਖ ਕੇ ਉਹ ਓ ਉਹੋ ਜਿਹਾ ਜੀਵਨ ਆਪਣੇ ਅਤੇ ਵਿੱਚ ਇੰਪਲੀਮੈਂਟ ਕਰਨ ਉਹੋ ਜਿਹੀਆਂ ਚੀਜ਼ਾਂ ਸਾਡੇ ਵਿੱਚ ਹੋ ਜਾਣੀਆਂ ਵਾ ਉਹ ਅਕਵਾਇਰ ਕਰਨ ਆਪਣੇ ਵਿੱਚ ਲੈਣ ਤਾਂ ਕਿ ਉਹ ਚੀਜ਼ਾਂ ਜਿਹੜੀਆਂ ਵਾ ਉਹ ਉਹਨਾਂ ਨੂੰ ਅੱਗੇ ਲੈ ਕੇ ਜ਼ਿੰਦਗੀ ਦੇ ਵਿੱਚ ਸਫਲਤਾ ਜਿਹੜੀ ਆ ਉਹ ਵਧੀਆ ਵਧੀਆ ਜੀਵਨ ਬਤੀਤ ਕਰਨ ਦੇ ਵਿੱਚ ਉਹਨਾਂ ਦਾ ਜਿਹੜੀ ਆ ਉਹ ਮਦਦ ਮਿਲੇ ਬਾਕੀ ਜਿਹੜਾ ਵਾ ਨਸ਼ੇ ਦੀ ਗੱਲ ਵੀ ਮੈਂ ਇਹਦੇ ਵਿੱਚ ਐਡ ਅਪ ਕਰਨਾ ਚਾਹਾਂਗਾ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਸਾਨੂੰ ਇਹਨਾਂ ਚੀਜ਼ਾਂ ਨੂੰ ਪੜ੍ਹਾਈ ਵਿੱਚ ਪੜ੍ਹਾਈ ਵਗੈਰਾ ਖੇਡਾਂ ਵਗੈਰਾ ਤਾਂ ਕਰੋ ਅਤੇ ਨਸ਼ਿਆਂ ਤੋਂ ਜਿਹੜਾ ਵਾ ਉਹ ਦੂਰ ਰਹਿਣਾ ਇੱਕ ਬਹੁਤ ਹੀ ਵੱਡੀ ਜਿਹੜੀ ਆ ਇੱਕ ਸਮੱਸਿਆ ਬਣਦੀ ਜਾ ਰਹੀ ਆ ਸਾਡੇ ਦੇਸ਼ ਦੀ ਉਹਨੂੰ ਵੀ ਮੈਂ ਇੱਕ ਐਡ ਕਰਨਾ ਚਾਹਾਂਗਾ ਵੀ ਸਾਨੂੰ ਇਹ ਚੀਜ਼ਾਂ ਨੂੰ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਵੀ ਸਾਨੂੰ ਨਸ਼ਿਆਂ ਤੋਂ ਜਿਹੜਾ ਵਾ ਉਹ ਦੂਰ ਰਹਿਣਾ ਚਾਹੀਦਾ ਵਾ ਇਹਨਾਂ ਦੇ ਜਿਹੜੇ ਸਾਈਡਸ ਫੈਕਟਸ ਜਿਹੜੇ ਆ ਉਹ ਕੀ ਆ ਉਹ ਸਾਰੇ ਸਾਨੂੰ ਜਿਹੜੇ ਆ ਇਹਦੇ ਬਾਰੇ ਬੱਚਿਆਂ ਨੂੰ ਦੱਸਣੇ ਚਾਹੀਦੇ ਆ ਤਾਂ ਕਿ ਉਹ ਉਹਨਾਂ ਦਾ ਸਰਬ ਪੱਖੀ ਵਿਕਾਸ ਜਿਹੜਾ ਵਾ ਉਹ ਹੋ ਸਕੇ